ਜੀ ਅਸੀਂ ਭਾਂਡਿਆਂ ਦੀ ਦੁਕਾਨ ਤੋਂ ਬੋਲਦੇ ਹਾਂਜੀ ਤੁਸੀਂ ਕੌਣ ਹਾਂਜੀ ਹਾਂਜੀ ਤੁਹਾਨੂੰ ਕਿੱਡਾ ਸਾਇਜ ਚਾਹੀਦਾ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੁਛ ਨੇ ਵਗੈਰਾ ਠੀਕ ਹੈ ਜੀ ਟੱਬ ਠੀਕ ਹੈ ਜੀ

ਇਹ ਤੋਲ ਕੇ ਮਿਲਣਗੇ ਪੰਜ ਸੌ ਰੁਪਏ ਦੇ ਕਿਲੋ ਹਿਸਾਬ ਨਾਲ ਮਿਲ ਜਾਣਗੇ ਤੁਹਾਨੂੰ ਹਾਂਜੀ ਸਾਰਾ ਕੁਛ ਹੀ ਇਹ ਸਟੀਲ ਵੀ ਹੋਊ ਐਲੂਮੀਨੀ ਐਲੂਮੀਨੀਅਮ ਵੀ ਹੋਊ ਐਲੂਮੀਨੀਅਮ ਵੀ ਹੋਊ ਸਟੀਲ ਵੀ ਹੋਊ ਅਤੇ ਪਿੱਤਲ ਵੀ ਮਿਲਜੂ ਉਹ ਐਲੂਮੀਨੀਅਮ ਦੀ ਹਾਂਜੀ

ਆਪਣੇ ਇੱਧਰ ਬਠਿੰਡਾ ਰੋਡ 'ਤੇ ਦੁਕਾਨ ਦਾ ਮਿੱਤਲ ਯੂਟੈਨਸਿਲ ਸਟੋਰ

ਹਾਂਜੀ ਹਾਂਜੀ ਠੀਕ ਹੈ ਜੇ ਤੁਸੀਂ ਆਓਗੇ ਉਦੋਂ ਕਾਰਡ ਲੈ ਜਿਓ ਨਾਲੇ ਭਾਂਡੇ ਵਗੈਰਾ ਦੇਖ ਜਿਓ

ਦੋਵੇਂ ਹੀ ਹੁੰਦੇ ਜੀ ਜੇ ਬਣਵਾਉਣੇ ਤਾਂ ਬਣਵਾਉਣ ਵਾਲੇ ਮਿਲ ਜਾਣਗੇ ਜੇ ਬਣੇ ਬਣਾਏ ਲੈਣੇ ਉਹ ਵੀ ਮਿਲ ਜਾਣਗੇ

ਛੋਟੇ ਵੀ ਮਿਲ ਜਾਂਦੇ ਵੱਡੇ ਵੀ ਮਿਲ ਜਾਂਦੇ ਆ ਆਮ ਘਰ ਵਾਲੇ ਵੀ ਮਿਲ ਜਾਂਦੇ ਆ ਹਲਵਾਈਆਂ ਵਾਲੇ ਵੀ ਹੈਗੇ ਹਾਂਜੀ ਸਾਰਾ ਕੁ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਸਭ ਕੁਝ ਮਿਲ ਜਾਣਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ